ਮੈਨੂੰ ਸਟੱਡੀ ਕਰਦੇ ਸਮੇਂ ਜੋ ਹੈ ਆਰਟ ਦਾ ਪੇਂਟਿੰਗ ਦਾ ਬਹੁਤ ਸ਼ੌਂਕ ਹੈ ਕਿ ਮਤਲਬ ਮੈਂ ਇੱਕ ਦਿਨ ਬੈਠੇ ਬੈਠੇ ਪੇਂਟਿੰਗ ਬਣਾਈ ਪਾਣੀ ਨਾਲ ਸੰਬੰਧਿਤ ਵੋਟਰ ਸੇਵ ਨਾਲ ਸੰਬੰਧਿਤ ਮੈਂ ਇੱਕ ਮਤਲਬ ਪੇਂਟਿੰਗ ਬਣਾਈ ਫਿਰ ਉਸਦੇ ਨਾਲ ਸੰਬੰਧਿਤ ਮੈਂ ਇੱਕ ਹੋਰ ਨਾਲ ਪੇਂਟਿੰਗ ਬਣਾਈ ਜਿਹਦੇ ਵਿੱਚ ਕਿ ਇੱਕ ਸਾਈਡ 'ਤੇ ਪਾਣੀ ਜੋ ਹੈ ਵੇਸਟ ਹੋ ਰਿਹਾ ਹੈ ਇੱਕ ਸਾਈਡ 'ਤੇ ਪਾਣੀ ਜੋ ਹੈ ਸੇਵ ਕ ਕਰਨ ਬਾਰੇ ਮਤਲਬ ਗਾਈਡ ਕੀਤਾ ਜਾ ਰਿਹਾ ਫਿਰ ਮੈਂ ਇਸ ਚੀਜ਼ ਨੂੰ ਦੇਖ ਮਤਲਬ ਡਰਾਇੰਗ ਕਰਕੇ ਦੇਖਿਆ ਕਿ ਇਸਦਾ ਬਹੁਤ ਹੀ ਇੱਕ ਡੂੰਘਾ ਅਰਥ ਨਿਕਲਦਾ ਹੈ ਕਿ ਅਗਰ ਇੱਕ ਸਾਈਡ 'ਤੇ ਪਾਣੀ ਵੇਸਟ ਹੋ ਰਿਹਾ ਹੈ ਕਿ ਅਸੀਂ ਅੱਜ ਦੇ ਟਾਈਮ ਵਿੱਚ ਪਾਣੀ ਵੇਸਟ ਕਰ ਰਹੇ ਹਾਂ ਮਤਲਬ ਕੱਲ੍ਹ ਨੂੰ ਸਾਨੂੰ ਉਸਦੀ ਮਹੱਤਤਾ ਪਤਾ ਲੱਗੇਗੀ ਅਗਰ ਅਸੀਂ ਅੱਜ ਵੇਸਟ ਕਰ ਰਹੇ ਹਾਂ ਤਾਂ ਅੱਜ ਉਸਦੀ ਵੈਲਿਊ ਸਾਨੂੰ ਨਹੀਂ ਪਤਾ ਮਹੱਤਤਾ ਉਸਦੀ ਨਹੀ ਪਤਾ ਬਟ ਲੇਕਿਨ ਜੇਕਰ ਅਸੀਂ ਉਸ ਚੀਜ਼ ਦੀ ਵੈਲਿਊ ਅੱਜ ਨਹੀਂ ਪਤਾ ਕਰਦੇ ਤਾਂ ਉਸਦੀ ਸਾਨੂੰ ਇੰਨਫਿਊਚਰ ਅੱਗੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਉਸਦੀ ਕਦਰ ਪਤਾ ਜਾਂ ਉਸਦੀ ਵੈਲਿਊ ਪਤਾ ਲੱਗਦੀ ਹੈ ਕਿ ਉਸ ਚੀਜ਼ ਨੂੰ ਅਸੀਂ ਵੇਸਟ ਕਰ ਚੁੱਕੇ ਹਾਂ ਤਾਂ ਉਸਦੀ ਕਿੰਨੀ ਵੈਲਿਊ ਹੈ ਇਸਦਾ ਇੱਕ ਅਤੇ ਇਸ ਪੇਂਟਿੰਗ ਦਾ ਮੈਂ ਮੈਨੂੰ ਅਹਿਸਾਸ ਹੋਇਆ ਕਿ ਹਾਂ ਇਸ ਪੇਂਟਿੰਗ ਦੇ ਥਰੂ ਮੈਂ ਕਿਸੇ ਨੂੰ ਬਹੁਤ ਹੀ ਇੱਕ ਡੂੰਘਾ ਅਰਥ ਸਮਝਾ ਸਕਦੀ ਹਾਂ ਅਤੇ ਪਾਣੀ ਨਾਲ ਸੰਬੰਧਿਤ ਜੋ ਹੈ ਉਸ ਪਾਣੀ ਦੀ ਮਹੱਤਤਾ ਨੂੰ ਮਤਲਬ ਬਿਆਨ ਕੀਤਾ ਜਾ ਸਕਦਾ ਹੈ ਥੈਂਕ ਯੂ